ਮੈਂ ਸਿੱਖ ਧਰਮ ਦਾ ਇੱਕ ਪ੍ਰਚਾਰਕ ਹਾਂ ਅਤੇ ਮੈਨੂੰ ਪ੍ਰਚਾਰ ਕਰਨ ਲਈ ਦੂਰ ਦੂਰ ਜਾਣਾ ਪੈਂਦਾ ਹੈ ਜਿਸ ਵਿੱਚ ਸਾਊਂਡ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਸਾਊਂਡ ਬਿਜਲੀ 'ਤੇ ਚੱਲਦਾ ਹੈ ਉਸ ਕਾਰਨ ਜੋ ਬਹੁਤ ਲੋਕਾਂ ਤੱਕ ਆਵਾਜ਼ ਪਹੁੰਚ ਸਕੇ ਜੇਕਰ ਬਿਜਲੀ ਨਾ ਹੋਵੇ ਤਾਂ ਸਾਊਂਡ ਦੀ ਜਿਹੜੀ ਵਿਵਸਥਾ ਹੈ ਉਹ ਨਹੀਂ ਚੱਲੇਗੀ ਸੋ ਇਸ ਕਰਕੇ ਸਾਊਂਡ ਦੇ ਕਾਰਨ ਬਿਜਲੀ ਦੇ ਕਾਰਨ ਸਾਨੂੰ ਜ਼ਰੂਰਤ ਰਹਿੰਦੀ ਹੈ ਜੋ ਥਾਂ ਥਾਂ 'ਤੇ ਜਾ ਕੇ ਅਸੀਂ ਸਿੱਖ ਧਰਮ ਗੁਰਬਾਣੀ ਦਾ ਧਰਮ ਦਾ ਪ੍ਰਚਾਰ ਕਰਦੇ ਹਾਂ ਬਿਜਲੀ ਦੇ ਕੱਟ ਦੌਰਾਨ ਸਾਨੂੰ ਦਿੱਕਤ ਆਉਂਦੀ ਹੈ ਕਿਉਂਕਿ ਸਾਊਂਡ ਕਾਰਨ ਫਿਰ ਉਹਦੇ ਕਾਰਨ ਸਾਨੂੰ ਥੋੜ੍ਹੀ ਦਿੱਕਤ ਆ ਜਾਂਦੀ ਹੈ ਇਸ ਕਰਕੇ ਅਸੀਂ ਫਿਰ ਇਹ ਲੋਕਾਂ ਦੇ ਵਿੱਚ ਇਨਵੈਟਰ ਦੀ ਜ਼ਰੂਰਤ ਟੋਰਚ ਦੀ ਜ਼ਰੂਰਤ ਪੈਂਦੀ ਹੈ ਸੋ ਇਸ ਕਰਕੇ ਸਾਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਸਾਡਾ ਜਿਹੜਾ ਬਿਜਲੀ ਦੇ ਕਾਰਨ ਬਹੁਤ ਜ਼ਿਆਦਾ ਬਿਜਲੀ ਦੀ ਜ਼ਰੂਰਤ ਰਹਿੰਦੀ ਹੈ ਸੋ ਇੱਥੇ ਲੋਕਾਂ ਨੂੰ ਫਿਰ ਕਾਫੀ ਇਨਵੈਟਰ ਦੀ ਵੀ ਲੋੜ ਪੈਂਦੀ ਹੈ ਟੋਰਚ ਦੀ ਵੀ ਲੋੜ ਪੈਂਦੀ ਹੈ ਜੇਕਰ ਬਿਜਲੀ ਨਾ ਹੋਵੇ ਤਾਂ ਬਹੁਤ ਕੰਮ ਰੁਕ ਸਕਦਾ ਹੈ ਤੋ ਸਾਊਂਡ ਕਾਰਨ ਜੋ ਸਾਡਾ ਪ੍ਰਚਾਰ ਹੈ ਸਿੱਖ ਧਰਮ ਦਾ ਉਹ ਪ੍ਰਚਾਰ ਦੌਰੇ 'ਤੇ ਸਾਨੂੰ ਜਾਣ ਦੀ ਜ਼ਰੂਰਤ ਰਹਿੰਦੀ ਹੈ ਬਹੁਤ ਜਗ੍ਹਾ 'ਤੇ ਜਾਂਦੇ ਹਾਂ ਸੋ ਇਸ ਕਰਕੇ ਬਿਜਲੀ ਦੀ ਬਹੁਤ ਲੋੜ ਹੈ